ਹਾਂਜੀ ਮੈਂ ਔਰਤਾਂ ਬਾਰੇ ਕੁਛ ਵਿਚਾਰ ਸਾਂਝੇ ਕਰਨਾ ਚਾਹੁੰਦੀ ਹਾਂ ਵੀ ਔਰਤਾਂ ਨੂੰ ਬੜੀਆਂ ਹੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਵਾ ਜਿਵੇਂ ਕਿ ਜਿਹੜੀ ਔਰਤ ਜੋਬ ਕਰਦੀ ਆ ਉਹਨੂੰ ਪਹਿਲਾਂ ਤਾਂ ਸਵੇਰੇ ਜਲਦੀ ਹੀ ਉੱਠਣਾ ਪੈਂਦਾ ਵਾ ਫੇਰ ਉਹ ਸਾਰਾ ਘਰ ਦਾ ਕੰਮ ਕਰਦੀ ਆ ਬੱਚੇ ਨੂੰ ਤਿਆਰ ਕਰਦੀ ਆ ਸਕੂਲ ਵਾਸਤੇ ਫਿਰ ਉਹ ਸਕੂਲ ਹੀ ਆਪ ਜੋਬ ਲਈ ਤਿਆਰ ਹੁੰਦੀ ਆ ਸਾਰੇ ਫਿਰ ਆਪਣੇ ਲਈ ਸਾਰਾ ਹੀ ਉਹ ਤਿਆਰ ਹੁੰਦੀ ਆ ਫਿਰ ਉਹਨੂੰ ਇੱਥੋਂ ਮਤਲਬ ਕਿ ਜੇ ਜਿੱਦਾਂ ਵੀ ਉਹਨੇ ਕਿਸੇ ਸ਼ਹਿਰ ਦੇ ਵਿੱਚ ਜੋਬ ਕਰਨ ਲਈ ਜਾਣਾ ਵਾ ਜਾਂ ਕਿਤੇ ਪਿੰਡ ਦੇ ਵਿੱਚ ਉਹਨੇ ਜੋਬ ਕਰਨ ਲਈ ਜਾਣਾ ਵਾ ਉਹਨੂੰ ਕੋਈ ਇੱਥੇ ਜਾਣ ਲਈ ਕੋਈ ਸਾਧਨ ਨਹੀਂ ਹੁੰਦਾ ਉਹ ਵਿਚਾਰੀ ਫਿਰ ਤੁਰ ਕੇ ਜਾਂ ਕਿੱਦਾਂ ਵੀ ਆਪਣਾ ਉਹ ਉੱਥੇ ਪਹੁੰਚਦੀ ਆ ਫੇਰ ਉਹਨੂੰ ਸ਼ਾਮ ਨੂੰ ਆ ਕੇ ਜਦੋਂ ਛੁੱਟੀ ਹੁੰਦੀ ਆ ਉਹ ਆਪਣਾ ਜਦੋਂ ਵੇ ਆ ਘਰ ਆਉਂਦੀ ਆ ਫਿਰ ਬੱਚਿਆਂ ਨੂੰ ਵੇਖਦੀ ਆ ਬੱਚਿਆਂ ਨੂੰ ਭੋਜਨ ਕਰਾਉਂਦੀ ਆ ਫੈਮਲੀ ਨੂੰ ਭੋਜਨ ਕਰਾਉਂਦੀ ਆ ਫਿਰ ਸਾਰਿਆਂ ਲਈ ਹਰੇਕ ਚੀਜ਼ ਮਤਲਬ ਸਾਰਿਆਂ ਲਈ ਉਹ ਧਿਆਨ ਰੱਖਦੀ ਆ ਵੀ ਕਿਹਨੂੰ ਕਿਹੜੀ ਚੀਜ਼ ਕਿੱਥੇ ਚਾਹੀਦੀ ਆ ਕਿਹਨੂੰ ਕੀ ਨਹੀਂ ਚਾਹੀਦਾ ਕਿਹਨੂੰ ਕੁਛ ਨਹੀਂ ਹੈ ਉਹਨੂੰ ਮਤਲਬ ਕਿ ਉਸ ਔਰਤ ਨੂੰ ਬਹੁਤ ਹੀ ਚੁਣੌ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਵਾ ਅਤੇ ਉਸ ਔਰਤ ਨੂੰ ਕੋਈ ਮਤਲਬ ਕਿ ਜਿੱਦਾਂ ਉਹ ਆਪ ਜੋਬ 'ਤੇ ਜਾਂਦੀ ਹੈ ਅਤੇ ਉਹਦੇ ਲਈ ਉਹਨੂੰ ਘਰ ਦੇ ਵਿੱਚ ਕੰਮ ਕਰਨ ਲਈ ਕੋਈ ਜਨਾਨੀ ਨਹੀਂ ਲੱਭਦੀ ਜਿੱਦਾਂ ਵੀ ਕੋਈ ਘਰ ਦੇ ਵਿੱਚ ਉਹਦੇ ਲਈ ਕੋਈ ਹੈ ਇਹ ਸਹਾਇਤਾ ਕਰੇ ਜਿਹੜੀਆਂ ਲੋਕ ਉਹ ਸ਼ਹਿਰ ਕੰਮ ਕਰਨ ਜਾਂਦੀਆਂ ਵਾ ਉਹਨੂੰ ਕਿਸੇ ਦੀ ਸਹਾਇਤਾ ਨਹੀਂ ਮਿਲਦੀ ਉਸ ਔਰਤ ਨੂੰ ਬਹੁਤ ਹੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਵਾ ਜਿੱਦਾਂ ਵੀ ਉਹ ਕਿਤੇ ਬਾਹਰ ਵੀ ਜਾਂਦੀ ਆ ਅਤੇ ਕਈ ਆਦਮੀ ਇਸ ਤਰ੍ਹਾਂ ਦੇ ਹੁੰਦੇ ਵੀ ਕੋਈ ਉਹਨਾਂ ਨੂੰ ਮਾੜੀ ਨਿਗ੍ਹਾ ਨਾਲ ਵੀ ਵੇਖਦੇ ਆ ਪਰ ਕਿ ਸਾਰੀਆਂ ਔਰਤਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ ਸਾਰੀਆਂ ਨ ਔਰਤਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ ਵੀ ਜਿਹੜੀਆਂ ਸਾਰੀਆਂ ਇੱਕੇ ਵੀ ਉਹ ਵੀ ਮਾੜੀਆਂ ਹੀ ਹੋਣ ਅਤੇ ਇਸ ਕਰਕੇ ਅਸੀਂ ਇਹੀ ਚਾਹੁੰਦੇ ਹਾਂ ਵੀ ਔਰਤ ਨੂੰ ਬਹੁਤ ਹੀ ਚੁਣੌਤੀਆਂ ਦਾ ਸਾਹਮਣਾ ਹੀ ਕਰਨਾ ਪੈਂਦਾ ਵਾ